ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਹਾਂਜੀ ਕਿਸ ਬਾਰੇ ਹਾਂਜੀ ਜ਼ਰੂਰ ਐਗਰੀਕਲਚਰ ਸੈਕਟਰ ਬਾਰੇ ਜਾਣਨਾ ਚਾਹੁੰਦੇ ਹੋ ਤੁਸੀਂ ਬਿਲਕੁਲ ਜੀ ਅ ਤੁਹਾਡਾ ਨਾਮ ਕੀ ਹੈ ਅਤੇ ਕਿੱਥੋਂ ਬੋਲ ਰਹੇ ਹੋ

ਅੱਛਾ ਅੱਛਾ ਜੀ ਅੱਛਾ ਅੱਛਾ ਮਤਲਬ ਤੁਸੀਂ ਉੱਧਰ ਦੀ ਕਿਸੀ ਯੂਨੀਵਰਸਿਟੀ ਵੱਲੋਂ ਰਿਸਰਚ ਕਰ ਰਹੇ ਹੋ ਨਾ ਹਾਂਜੀ ਠੀਕ ਹੈ ਜੀ ਮੈਂ ਤੁਹਾਨੂੰ ਦੱਸ ਦਿੰਦਾ ਪੰਜਾਬ ਜਿਹੜਾ ਹੈ ਉਹ ਦੋ ਹਜ਼ਾਰ ਇੱਕ ਦੀ ਕੈਲਕੂਲੇਸ਼ਨ ਦੇ ਅਕੋਰਡਿੰਗ ਪਰ ਕੈਪੀਟਲ ਇਨਕਮ ਅਤੇ ਜੀ ਡੀ ਪੀ ਦੇ ਵਿੱਚ ਚੌਥੇ ਨੰਬਰ 'ਤੇ ਆਉਂਦਾ ਠੀਕ ਹੈ ਜੀ ਅਤੇ ਆਪਣਾ ਜਿਹੜਾ ਪੰਜਾਬ ਹੈ ਪੰਜਾਬ ਦੇ ਵਿੱਚ ਐਗਰੀਕਲਚਰ ਲਾ ਲਓ ਆਪਣਾ ਟਵੈਂਟੀ ਸੈਵਨ ਤੋਂ ਟਵੈਂਟੀ ਏਟ ਪਰਸੈਟ ਐਗਰੀਕਲਚਰ ਦਾ ਕੰਟਰੀਬਿਊਸ਼ਨ ਹੈਗਾ ਪੰਜਾਬ ਦੀ ਇਕੋਨਮੀ ਦੇ ਵਿੱਚ ਅਤੇ ਇਸ ਦੇ ਵਿੱਚ ਸਭ ਤੋਂ ਵੱਧ ਕੰਟ੍ਰੀਬਿਊਸ਼ਨ ਆਪਣਾ ਬੀਟ ਜਿਹਨੂੰ ਕਿ ਕਣਕ ਕਹਿ ਦਿੰਦੇ ਹਾਂ ਅਤੇ ਦੂਜਾ ਜੀਰੀ ਜਿਹਨੂੰ ਆਪਾਂ ਚੌਲ ਕਹਿ ਦਿੰਦੇ ਹਾਂ ਇਹਨਾਂ ਦਾ ਹੁੰਦਾ ਹੋਰ ਉਸ ਤੋਂ ਬਾਅਦ ਕੁਝ ਸਬਜ਼ੀਆਂ ਵੀ ਆ ਜਾਂਦੀਆਂ ਨੇ ਜਿਵੇਂ ਕਿ ਪਿਆਜ ਟਮਾਟਰ ਆਲੂ ਇਹਨਾਂ ਦਾ ਵੀ ਕਾਫੀ ਕੰਟਰੀਬਿਊਸ਼ਨ ਹੁੰਦਾ ਪਰ ਸਭ ਤੋਂ ਵੱਧ ਗੰਨੇ ਦੀ ਫ਼ਸਲ ਕਣਕ ਦਾ ਅਤੇ ਚੌਲਾਂ ਦਾ ਬਾਜਰੇ ਦਾ ਇਹਨਾਂ ਚੀਜ਼ਾਂ ਦਾ ਹੁੰਦਾ ਅਤੇ ਜੇ ਆਪਾਂ ਨੰਬਰਸ ਦੀ ਗੱਲ ਕਰੀਏ ਤਾਂ ਫੌਰਟੀ ਫਾਈਵ ਪੁਆਇੰਟ ਨਾਈਨ ਵੰਨ ਪਰਸੈਂਟ ਐਗਰੀਕਲਚਰ ਦਾ ਕੰਟਰੀਬਿਊਸ਼ਨ ਹੈਗਾ ਜਿਸ ਦੇ ਵਿੱਚ ਟਵੈਂਟੀ ਫਾਈਵ ਪੁਆਇੰਟ ਫਾਈਵ ਟੂ ਪਰਸੈਂਟ ਐਗਰੀਕਲਚਰ ਦੀ ਰੇਸ਼ੋ ਹੈਗੀ ਪੰਜਾਬ ਦੇ ਵਿੱਚ ਐਨੁਅਲ ਇੰਨਕਮ ਡਿਪੈਂਡ ਕਰਦਾ ਫਾਰਮਰ ਦੇ ਕੋਲ ਲੈਂਡ ਕਿੰਨੀ ਕੁ ਹੈ ਜਿਹੜੇ ਛੋਟੇ ਫਾਰਮਰਸ ਹੁੰਦੇ ਨੇ ਉਹਨਾਂ ਦੀ ਮੰਥਲੀ ਇਨਕਮ ਜਾਂ ਐਨੂਅਲ ਇਨਕਮ ਆਪਾਂ ਚਾਰ ਲੱਖ ਪੰਜ ਲੱਖ ਰੁਪਿਆ ਤੋਂ ਸਟਾਰਟ ਹੋ ਜਾਂਦੀ ਹੈ ਅਤੇ ਜਿਵੇਂ ਜਿਵੇਂ ਉਹਨਾਂ ਦਾ ਲੈਂਡ ਵੱਧਦਾ ਜਾਂਦਾ ਉਵੇਂ ਉਵੇਂ ਇਨਕਮ ਵੀ ਵੱਧ ਜਾਂਦੀ ਹੈ

ਪੜ ਪਰ ਏਕੜ ਨੂੰ ਦੱਸ ਰਿਹਾ ਮੈਂ ਇਹ ਹਾਂ ਪਰ ਏਕੜ ਤੁਸੀਂ ਕਹਿ ਸਕਦੇ ਹੋ ਇਕ ਐਵਰੇਜ ਛੋਟਾ ਫਾਰਮਰ ਹੁੰਦਾ ਜਿਹਦਾ ਜਿਹਦੇ ਕੋਲ ਇੱਕ ਏਕੜ ਜਮੀਨ ਹੈ ਮੰਨ ਲਓ ਉਹਦੀ ਚਾਰ ਤੋਂ ਪੰਜ ਲੱਖ ਰੁਪਿਆ ਇਕ ਸਾਲ ਦੀ ਆਮਦਨ ਹੋਊਗੀ ਹਾਂਜੀ ਬਾਕੀ ਜੇ ਤੁਸੀਂ ਹੋਰ ਕੁਛ ਡਿਟੇਲ ਵਿੱਚ ਜਾਣਨਾ ਹੋਏ ਤਾਂ ਤੁਸੀਂ ਮੈਨੂੰ ਮਿਲ ਲਿਓ ਠੀਕ ਹੈ ਜੀ ਓਕੇ ਜੀ